ਹੈਲੋ ਸਤਿ ਸ਼੍ਰੀ ਅਕਾਲ ਸਰ ਜੀ ਸਰ ਜੀ ਤੁਸੀਂ ਕੱਲ੍ਹ ਆਪਣੇ ਭਾਰਤ ਗੈਸ ਏਜੰਸੀ ਤੋਂ ਬੋਲ ਰਹੇ ਹੋ ਜੀ ਹਾਂਜੀ ਤੁਸੀਂ ਕੱਲ੍ਹ ਸਲੈਂਡਰ ਡਿਲੀਵਰ ਕਰਕੇ ਗਏ ਸੀ ਜੀ ਪਿੰਡ ਅਤੇ ਉਹਦਾ ਵੇਟ ਘੱਟ ਹੈ ਜੀ ਮੈਂ ਇਹ ਪੁੱਛ ਰਿਹਾ ਸੀਗਾ ਉਹਦਾ ਅਸੀਂ ਹਾਂ ਅੰਮ੍ਰਿਤਪਾਲ ਸਿੰਘ ਦੇ ਨਾਮ 'ਤੇ ਹੋਇਆ ਸੀ ਜੀ ਹਾਂਜੀ ਹਾਂਜੀ ਦੱਸ ਦਿੰਦੇ ਹਾਂ ਜੀ ਪੈਂਹਠ ਪਚਾਸੀ

ਹਾਂਜੀ ਸਾਡੀ ਇਹ ਪਾਸਬੁੱਕ ਅ ਦਾ ਨੰਬਰ ਹੈ ਹਾਂਜੀ ਹਾਂਜੀ ਕਿਉਂਕਿ ਨਾ ਅਸੀਂ ਹੁਣ ਵੇਟ ਤੋਲਿਆ ਹੈਗਾ ਤਾਂ ਉਹ ਘੱਟ ਆ ਰਿਹਾ ਹੈ ਉਹਦਾ ਵੀ ਵੇਟਿੰਗ ਜੀ ਹਾਂਜੀ ਨਹੀਂ ਉਦੋਂ ਐਟ ਏ ਟੈਮ ਤਾਂ ਨਹੀਂ ਕੀਤਾ ਜੀ ਉਦੋਂ ਤਾਂ ਅਸੀਂ ਵੈਸੇ ਹੀ ਲੈ ਗਏ ਸੀ ਜਦੋਂ ਘਰ ਲੈ ਕੇ ਆਂਦਾ ਹੈਗਾ ਉਸ ਤੋਂ ਬਾਅਦ ਅਸੀਂ ਘਰ ਵੇਟ ਕੀਤਾ ਹੈ ਤਾਂ ਘੱਟ ਆ ਰਿਹਾ ਹੈ ਜੀ ਅ ਜੀ ਅਸੀਂ ਅ ਕ ਦੂਸਰੇ ਅ ਘਰ ਹੀ ਕੰਡਾ ਹੁੰਦਾ ਉਸ 'ਤੇ ਕੀਤਾ ਜੀ ਹਾਂਜੀ ਇਸ ਦਾ ਵੇਟ ਜੀ ਅਠਾਰਾਂ ਕੁ ਦੇ ਨੇੜੇ ਆਇਆ ਜੀ ਅਠਾਰਾਂ ਤੋਂ ਘੱਟ ਹੀ ਘੱਟ ਹੀ ਆਇਆ ਜੀ ਘੱਟ ਹੀ ਆਇਆ ਵੈਸੇ ਤਾਂ ਪ੍ਰੋਪਰ ਅਠਾਰਾਂ ਹੁੰਦਾ ਉਸ ਤੋਂ ਘੱਟ ਆਇਆ ਜੀ ਪੰਦਰਾਂ ਪੁੰਦਰਾਂ ਦੇ ਨੇੜੇ ਹੈ ਜੀ ਚੌਦਾਂ ਪੰਦਰਾਂ ਦੇ ਨੇੜੇ ਠੀਕ ਹੈ ਜੀ ਨਹੀਂ ਜੀ ਕੁਛ ਨਹੀਂ ਅਸੀਂ ਜਦੋਂ ਚੱਕਿਆ ਉਦੋਂ ਹੀ ਵੈਸੇ ਹੀ ਵੇਟ ਹਲਕਾ ਜਿਹਾ ਦਿਖ ਰਿਹਾ ਸੀ ਵੀ ਐਵੇਂ ਲੱਗ ਰਿਹਾ ਸੀ ਵੀ ਵਿੱਚ ਗੈਸ ਬਹੁਤ ਘੱਟ ਹੋਊਗੀ ਜੀ ਜੀ ਠੀਕ ਹੈ ਜੀ ਕੱਲ੍ਹ ਠੀਕ ਹੈ ਜੀ ਧੰਨਵਾਦ ਜੀ ਧੰਨਵਾਦ ਠੀਕ ਧੰਨਵਾਦ ਜੀ